ਜੀ ਹਾਂ ਮੈਂ ਪੰਜਾਬ ਵਿੱਚ ਰਹਿੰਦੀ ਹਾਂ ਅਤੇ ਪੰਜਾਬ ਦੀ ਉਪਭਾਸ਼ਾ ਦੀ ਵਰਤੋਂ ਕਰਦੀ ਹਾਂ ਪੰਜਾਬ ਦੀ ਉਪਭਾਸ਼ਾ ਇੱਕ ਨਹੀਂ ਹੈ ਕਈ ਤਰ੍ਹਾਂ ਦੀਆਂ ਹਨ ਕਿਉਂਕਿ ਹਰੇਕ ਇਲਾਕੇ ਦੇ ਵਿੱਚ ਭਾਸ਼ਾਵਾਂ ਵੱਖਰੀਆਂ ਵੱਖਰੀਆਂ ਹਨ ਅਤੇ ਭਿੰਨ ਭਿੰਨ ਅਤੇ ਭਿੰਨ ਭਿੰਨ ਰੂਪਾਂ ਨੂੰ ਉਸ ਭਾਸ਼ਾ ਦੇ ਉਪਭਾਸ਼ਾ ਵੀ ਕਿਹਾ ਜਾਂਦਾ ਹੈ ਪੰਜਾਬ ਦੀਆਂ ਉਚ ਉਪ ਭਾਸ਼ਾਵਾਂ ਦਰਿਆ ਸਤਲੁਜ ਬਿਆਸ ਰਾਵੀ ਜੇਹਲਮ ਅਤੇ ਝਨਾਬ ਆਦਿ ਦੇ ਇਲਾਕਿਆਂ ਵਿੱਚੋਂ ਪੈਦਾ ਹੋਈਆਂ ਹਨ ਕਿਸੇ ਵੀ ਉਪਭਾਸ਼ਾ ਦਾ ਘੇਰਾ ਕਿਸੇ ਖ਼ਾਸ ਇਲਾਕੇ ਤੱਕ ਸੀਮਤ ਨਹੀਂ ਹੁੰਦਾ ਹਰੇਕ ਉਪਭਾਸ਼ਾ ਦਾ ਆਪਣਾ ਉਚਾਰਨ ਲਹਿਜਾ ਅਤੇ ਸ਼ਬਦਾਵਲੀ ਦਾ ਪੱਧਰ ਹੁੰਦਾ ਹੈ ਪਰ ਉਹਨਾਂ ਵਿਚਾਲੇ ਵਿਆਕਰਨ ਨਿਯਮ ਸਮਾਨਤਾ ਅਤੇ ਪੱਧਰ ਦੇ ਵੀ ਵਿਚਾਲੇ ਹਨ ਇਸ ਕਰਕੇ ਹਰੇਕ ਵ ਵੱਖ ਵੱਖ ਉਪਭਾਸ਼ਾਵਾਂ ਦੇ ਬੁਲਾਰੇ ਆਪਸ ਵਿੱਚ ਸਾਂਝੇ ਸਮਝੇ ਜਾਂਦੇ ਹਨ ਪੰਜਾਬੀ ਉਹ ਭਾਸ਼ਾ ਆਦੀ ਉਪਭਾਸ਼ਾਵਾਂ ਕਿਸੇ ਵੀ ਮਾਝੇ ਮਲਵਈ ਦੁਆਬੀ ਪੁਆਧੀ ਪੋਠਾਹਾਰੀ ਮੁਲਤਾਨੀ ਆਦਿ ਹਨ ਪੁਰਾਣੇ ਸਮਿਆਂ ਵਿੱਚ ਵਿਸ਼ੇਸ਼ ਭੂਗੋਲਿਕ ਸਥਿਤੀਆਂ ਹੋਣ ਦੇ ਕਾਰਨ ਅਤੇ ਆਵਾਜਾਈ ਦੀਆਂ ਸਹੂਲਤਾਂ ਨਾ ਹੋਣ ਕਾਰਨ ਇੱਕ ਖੇਤਰ ਵਿੱਚ ਲੋਕਾਂ ਦਾ ਦੂਸਰੇ ਕਿੱਤੇ ਦੇ ਲੋਕਾਂ ਨਾਲ ਕੋਈ ਬਹੁਤਾ ਮੇਲ ਜੋਲ ਨਹੀਂ ਸੀ ਹੁੰਦਾ ਇਸ ਲਈ ਇਹਨਾਂ ਇਸ ਤੋਂ ਇਲਾਵਾ ਸੰਚਾਰ ਸਾਧਨ ਦਾ ਵੀ ਕੋਈ ਬਹੁਤਾ ਵਿਕਾਸ ਨਹੀਂ ਸੀ ਹੁੰਦਾ ਜਿ ਜਿਸ ਕਾਰਨ ਕਿ ਇੱਕ ਪ੍ਰਾਂਤ ਜਾਂ ਇਲਾਕੇ ਦੇ ਵਿੱਚ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਦਾ ਉਚਾਰਨ ਅਤੇ ਸ਼ਬਦਾਵਲੀ ਪੱਖ ਤੋਂ ਥੋੜ੍ਹਾ ਬਹੁਤ ਅੰਤਰ ਹੁੰਦਾ ਹੈ ਪਹਾੜਾਂ ਵਿੱਚ ਪਹਾੜੀ ਭਾਸ਼ਾ ਬੋਲੀ ਜਾਂਦੀ ਹੈ